ਮੈਨੂੰ ਹਰਿਆਲੀ ਬਹੁਤ ਜ਼ਿਆਦਾ ਪਸੰਦ ਹੈ ਮੈਂ ਪਹਿਲੀ ਵਾਰ ਆਪਣੇ ਸਿਕਸਤ ਕਲਾਸ ਦੇ ਵਿੱਚ ਇੱਕ ਦਰਖਤ ਲਗਾਇਆ ਸੀ ਜੋ ਜਾਮਣ ਦਾ ਦਰਖਤ ਸੀ ਉਸ ਤੋਂ ਬਾਅਦ ਮੈਂ ਆਪਣੇ ਹਰ ਬਰਡੇਅ 'ਤੇ ਇੱਕ ਪਲਾਂਟ ਲਗਾਉਂਦੀ ਹਾਂ ਮੈਂ ਸਾਡੇ ਘਰ ਦੇ ਵਿੱਚ ਸਾਈਡ 'ਤੇ ਇੱਕ ਛੋਟੀ ਜਿਹੀ ਬਾਗਬਾਨੀ ਬਣਾਈ ਹੋਈ ਹੈ ਜਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕੁਝ ਫੁੱਲਾਂ ਦੇ ਕੁਝ ਫਲਾਂ ਦੇ ਅਤੇ ਕੁਝ ਸਬਜ਼ੀਆਂ ਦੇ ਪੌਦੇ ਵੀ ਹਨ ਅਤੇ ਇੱਕ ਵਿਚਾਲੇ ਨਿੰਮ ਵੀ ਹੈ ਜੋ ਬਹੁਤ ਜ਼ਿਆਦਾ ਸੰਘਣੀ ਛਾਂ ਦਿੰਦੀ ਹੈ ਸਾਨੂੰ ਦਰਖਤਾਂ ਤੋਂ ਬਹੁਤ ਕੁਝ ਮਿਲਦਾ ਹੈ ਦਰਖਤ ਸਾਨੂੰ ਆਕਸੀਜਨ ਦਿੰਦੇ ਹਨ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ ਅਤੇ ਮੈਨੂੰ ਹਰਿਆਲੀ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਨਿੰਬੂ ਮਿਰਚਾਂ ਗੁਲਾਬ ਦੇ ਫੁੱਲ ਗੇਂਦੇ ਦੇ ਫੁੱਲ ਅਤੇ ਬਹੁਤ ਹੀ ਵੱਖ ਵੱਖ ਤਰ੍ਹਾਂ ਦੇ ਨਿੱਕੇ ਨਿੱਕੇ ਪਿਆਰੇ ਪਿਆਰੇ ਫੁੱਲ ਹਨ ਮੇਰੀ ਬਾਗਬਾਨੀ ਦੇ ਵਿੱਚ ਅਤੇ ਮੈਂ ਰੋਜ਼ ਰੋਜ਼ਾਨਾ ਸ਼ਾਮ ਨੂੰ ਜਾ ਕੇ ਆਪਣੀ ਬਾਗਬਾਨੀ ਦੇ ਵਿੱਚ ਆਪਣੇ ਪੌਦਿਆਂ ਨੂੰ ਮਤਲਬ ਪਾਣੀ ਦਿੰਦੀ ਹਾਂ ਅਤੇ ਜਦੋਂ ਵੀ ਮੈਂ ਉੱਥੇ ਜਾਂਦੀ ਹਾਂ ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ